ਮੈਂ ਪਠਾਣਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਤੁਹਾਡੇ ਤੁਹਾਨੂੰ ਇਹ ਜਾਣ ਦੱਸਣਾ ਜਾਂ ਦਿਖਾ ਰਿਹਾ ਹਾਂ ਕਿ ਕੁਝ ਦਿਨਾਂ ਪਹਿਲਾਂ ਤੁਹਾਡੇ ਕੋਲ ਆਪਣੇ ਲਈ ਇੱਕ ਐਨਕ ਵੇਚਣ ਆਇਆ ਸੀ ਤਾਂ ਜੋ ਕਿ ਮੈਂ ਧੁੱਪ ਤੋਂ ਬਚਾ ਤੋਂ ਬਚਣ ਵਾਸਤੇ ਖਰੀਦਣਾ ਖਰੀਦਣੀ ਸੀ ਜਿਸ ਨੂੰ ਅਸੀਂ ਸਨ ਗਲਾਸੀਸ ਵੀ ਆਖਦੇ ਹਾਂ ਅਤੇ ਮੈਂ ਤੁਹਾਡੇ ਕੋਲ ਵਲੋਂ ਕੁਝ ਵੱਖ ਵੱਖ ਰੰਗਾਂ ਦੇ ਡਿਜ਼ਾਇਨ ਦੀਆਂ ਐਨਕਾਂ ਵੇਖੀਆਂ ਗਈਆਂ ਜਿਸ ਵਿੱਚ ਮੈਨੂੰ ਇੱਕ ਰੰਗ ਬਹੁਤ ਚੰਗਾ ਲੱਗਾ ਸੀ ਅਤੇ ਮੈਂ ਤੁਹਾਨੂੰ ਉਹ ਪਾਕ ਪੈਕ ਕਰਨ ਵਾਸਤੇ ਕਿਹਾ ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਉਸ ਉੱਤੇ ਕੁਝ ਡਿਸਕਾਊਂਟ ਵੀ ਦੇ ਦਿੱਤਾ ਅਤੇ ਮੈਨੂੰ ਤੁਹਾਡੇ ਕੋਲ ਇਹ ਦੱਸਿਆ ਗਿਆ ਸੀ ਕਿ ਇਹ ਸਾਡੀ ਦੁਕਾਨ ਦੀ ਆਪ ਬਣਾਈ ਹੋਈ ਸਭ ਤੋਂ ਮਜ਼ ਮਸ਼ਹੂਰ ਐਨਕ ਹੈ ਜੋ ਕਿ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਵਿਕਦੀ ਹੈ ਪਰ ਜਦੋਂ ਮੈਂ ਘਰ ਗਿਆ ਤਾਂ ਮੈਂ ਇਸ ਨੂੰ ਪਾ ਕੇ ਬਹੁਤ ਖੁਸ਼ ਹੋਇਆ ਸੀ ਹੁਣ ਇਹ ਅੱਜ ਕੁਝ ਘੰਟਿਆਂ ਪਹਿਲਾਂ ਹੀ ਗੱਲ ਹੈ ਕਿ ਕੁਝ ਦਿਨਾਂ ਤੋਂ ਮੈਨੂੰ ਇਹ ਪਾਈ ਹੋਈ ਬਹੁਤ ਢਿੱਲੀ ਲੱਗਣ ਲੱਗੀ ਰਹੀ ਸੀ ਮੈਨੂੰ ਲੱਗਦਾ ਸੀ ਇਸ ਇਸਦਾ ਇਸਦਾ ਨੱਟ ਜਿਹੜਾ ਕਿ ਹੈ ਕਿ ਕੁਝ ਬਹੁਤ